ਹੈਲੋ ਹੋਰ ਸ਼ਵੇਤਾ ਕੀ ਹਾਲ ਹੈ ਅਸੀਂ ਵਧੀਆ ਹੈਗੇ ਕਿੱਥੇ ਰਹਿੰਦੀ ਅੱਜ ਕੱਲ੍ਹ ਅੱਛਾ ਅਸੀਂ ਤਾਂ ਪਿੰਡ ਵਿੱਚ ਸ਼ਹਿਰ ਤੋਂ ਆਉਂਦੇ ਪਏ ਆ ਹਾਂ ਸ਼ਹਿਰ ਦੇ ਵਿੱਚ ਬੜੇ ਫਾਇਦੇ ਨੇ ਰਹਿਣ ਦੇ ਪਿੰਡਾਂ 'ਚ ਉਨੀਆਂ ਸਹੂਲਤਾਂ ਨਹੀਂ ਮਿਲਦੀਆਂ ਜਿੰਨੀਆਂ ਸ਼ਹਿਰ 'ਚ ਮਿਲਦੀਆਂ ਨੇ ਹਾਂ ਉਹ ਫਿਰ ਵਹੀਕਲ ਲੈ ਲਵਾਂਗੇ ਨਾ ਵਹੀਕਲ 'ਤੇ ਜਾਇਆ ਕਰਾਂਗੇ ਨਹੀਂ ਨਹੀਂ ਵਹੀਕਲ ਮਿਲ ਜਾਂਦੇ ਨੇ ਸ਼ਹਿਰ 'ਚ ਤਾਂ ਵਾਧੂ ਮਿਲ ਜਾਂਦੇ ਨੇ ਵਹੀਕਲ

ਉਹ ਸ਼ਹਿਰ ਵਿੱਚ ਆਵਾਂਗੇ ਤਾਂ ਸਾਰਾ ਕੁਛ ਪਤਾ ਲੱਗ ਜਾਂਦਾ ਫਿਰ

ਸ਼ਹਿਰ ਦੇ ਵਿੱਚ ਸਹੂਲਤਾਂ ਸਾਰੀਆਂ ਹੀ ਮਿਲ ਜਾਂਦੀਆਂ ਨੇ ਟੀਚਰ ਪਹਿਲਾਂ ਪੜ੍ਹਾਈ ਦੇ ਬੇਸ 'ਤੇ ਵੇਖੀਏ ਤਾਂ ਆਪਾਂ ਨੂੰ ਟੀਚਰ ਬੜੇ ਵਧੀਆ ਮਿਲ ਜਾਂਦੇ ਨੇ ਸਕੂਲ ਵੀ ਇੱਥੇ ਬਹੁਤ ਵਧੀਆ ਤੋਂ ਵਧੀਆ ਹੀ ਹੈਗੇ ਨੇ ਅਤੇ ਜੇ ਆਪਾਂ ਸ਼ਾਮ ਨੂੰ ਟਿਊਸ਼ਨ ਰੱਖਣਾ ਚਾਹੀਦਾ ਮੈਡਮਾਂ ਵਧੀਆ ਮਿਲ ਜਾਂਦੀਆਂ ਨੇ ਅਤੇ ਪੜ੍ਹਾਈ ਦਾ ਇੰਤਜ਼ਾਮ ਹਾਂਜੀ ਮਿਲ ਜਾਏਗਾ ਉਹ ਤਾਂ ਜਿਸ ਤਰ੍ਹਾਂ ਦੀ ਆਪਾਂ ਥਾਂ ਵੇਖਾਂਗੇ ਉਸ ਹਿਸਾਬ 'ਤੇ ਰੇਟ ਲੱਗ ਜਾਏਗਾ ਆਪਾਂ ਨੂੰ ਹਾਂਜੀ ਲੈਣੇ ਪੈਂਦੇ ਨੇ ਫਿਰ ਆਪਦੀ ਸਹੂਲਤ ਬਾਲਨੀ ਤਾਂ ਲੈਣੇ ਹੀ ਪੈਣੇ ਨੇ ਥੋੜ੍ਹੀ ਬਹੁਤ ਆਪਦੀ ਨੌਕਰੀ ਵਾਸਤੇ ਇੰਤਜ਼ਾਮ ਕਰਨਾ ਪੈਂਦਾ ਆਪਦਾ ਖਰਚਾ ਤਾਂ ਕੱਢਣਾ ਹੀ ਹੁੰਦਾ ਫਿਰ ਅੱਛਾ ਨਹੀਂ ਪੱਕਾ ਹੀ ਲੈਣਾ ਸ਼ਹਿਰ ਦੇ ਵਿੱਚ ਹੀ ਲੈਣਾ ਹਾਂਜੀ ਸਹੂਲਤਾਂ ਤਾਂ ਵਾਧੂ ਨੇ ਨਹੀਂ ਪੜ੍ਹਿਆ ਕਿਉਂ ਨਹੀਂ ਜਾਣਾ ਵਾਧੂ ਇੰਤਜ਼ਾਮ ਵੀ ਤਾਂ ਬੜੇ ਹੁੰਦੇ ਨੇ ਨਾ ਹਾਂ ਮਿਲ ਜਾਣਗੇ ਨੇੜੇ ਹੀ ਮਿਲ ਜਾਣਗੇ ਨਹੀਂ ਪਤਾ ਕਰਨ ਦੀ ਲੋੜ ਹੀ ਨਹੀਂ ਅਸੀਂ ਕਰ ਲਿਆ ਪਤਾ ਸਾਰਾ ਤੁਸੀਂ ਆਓ ਤਾਂ ਸਹੀ ਇੱਕ ਵਾਰੀ ਸ਼ਹਿਰ ਵਿੱਚ

ਬਸ ਸਟੈਂਡ 'ਤੇ ਮਿਲ ਜਾਂਦੀ ਨਾ ਬ ਬਸ ਸਟੈਂਡ ਬਸ ਸਟੈਂਡ 'ਤੇ ਮਿਲੇਗੀ ਓਕੇ ਓਕੇ ਬਸ ਠੀਕ ਹੈ ਪਹੁੰਚ ਜਾਵਾਂਗੀ